ਮੇਰੀ ਸਭ ਤੋਂ ਵੱਡੀ ਸ਼ਕਤੀ ਹੈ ਕਿ ਮੈਂ ਕੰਮ ਕਰਨ ਦੇ ਵਿੱਚ ਝਿਜਕ ਨਹੀਂ ਮਹਿਸੂਸ ਕਰਦਾ ਕੰਮ ਕੋਈ ਵੀ ਹੋਵੇ ਚਾਹੇ ਮੈਂ ਬੇਸ਼ਰਮ ਹੋ ਕੇ ਬੇਝਿਜਕ ਹੋ ਕੇ ਕੰਮ ਨੂੰ ਕਰਦਾ ਹਾਂ ਅਤੇ ਕਮਜ਼ੋਰੀ ਮੇਰੀ ਇਹ ਹੈ ਕਿ ਮੈਂ ਕੋਈ ਵੀ ਚੀਜ਼ ਨੂੰ ਮਤਲਬ ਜਦੋਂ ਸੋਚਦਾ ਤਾਂ ਮੈਨੂੰ ਯਾਦ ਨਹੀਂ ਆਉਂਦੀ ਪੁਰਾਣੀਆਂ ਚੀਜ਼ਾਂ ਨੂੰ ਮੈਂ ਭੁੱਲ ਜਾਂਦਾ ਹਾਂ ਬਹੁਤ ਜਲਦੀ